ਬਚਪਨ ਤੋਂ ਹੀ ਮੈਨੂੰ ਸੰਗੀਤ ਦਾ ਸ਼ੌਂਕ ਹੈ ਅਤੇ ਮੈਂ ਆਪਣੀ ਸਾਰੀ ਪੜ੍ਹਾਈ ਸੰਗੀਤ ਵਿੱਚ ਹੀ ਹਾਸਿਲ ਕੀਤੀ ਹੈ ਦੋ ਹਜ਼ਾਰ ਸਤਾਰ੍ਹਾਂ ਤੋਂ ਲੈ ਕੇ ਦੋ ਹਜ਼ਾਰ ਉੱਨੀ ਤੱਕ ਮੈਂ ਸ਼ਾਸਤਰੀ ਸੰਗੀਤ ਦੀ ਐੱਮ ਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਉਸ ਸਮੇਂ ਦੌਰਾਨ ਮੈਨੂੰ ਬਹੁਤ ਚੰਗੇ ਸ਼ਾਸਤਰੀ ਸੰਗੀਤ ਦੇ ਉਸਤਾਦਾਂ ਕੋਲੋਂ ਇਹ ਸੰਗੀਤ ਸਿੱਖਣ ਦਾ ਅਤੇ ਗਾਉਣ ਦਾ ਮੌਕਾ ਮਿਲਿਆ ਜਦੋਂ ਜਦੋਂ ਮੈਂ ਇਸ ਸੰਗੀਤ ਨੂੰ ਗਾਇਆ ਅਤੇ ਗਾਉਂਦਾ ਹਾਂ ਮੈਨੂੰ ਬਹੁਤ ਹੀ ਆਤਮਿਕ ਆਨੰਦ ਮਿਲਦਾ ਹੈ ਅਤੇ ਹੋਰ ਸਮਕਾਲੀ ਸੰਗੀਤ ਨਾਲੋਂ ਇਹ ਸੰਗੀਤ ਕਾਫੀ ਜ਼ਿਆਦਾ ਮੁਸ਼ਕਿਲ ਹੈ ਅਤੇ ਇਸ ਨੂੰ ਸਿੱਖਣ ਦੇ ਲਈ ਅਤੇ ਗਾਉਣ ਦੇ ਲਈ ਬਹੁਤ ਸਾਰੀ ਅਤੇ ਘੋਰ ਸਾਰੀ ਤਪੱਸਿਆ ਹੀ ਕਰਨੀ ਪੈਂਦੀ ਹੈ ਅਤੇ ਕਈ ਸਾਰੇ ਘੰਟਿਆਂ ਤੋਂ ਬਾਅਦ ਜਾ ਕੇ ਹੀ ਇਹ ਸੰਗੀਤ ਨੂੰ ਸਾਧਿਆ ਜਾ ਸਕਦਾ ਹੈ ਅਤੇ ਸਿੱਖਿਆ ਜਾ ਸਕਦਾ ਹੈ ਬਲਕਿ ਕਈ ਉਸਤਾਦ ਤਾਂ ਕਈ ਦਹਾਕਿਆਂ ਤੱਕ ਹੀ ਇਸ ਦਾ ਰਿਆਜ਼ ਅਤੇ ਅਕੀਦਾ ਕਰਦੇ ਹਨ ਇਸ ਤਰ੍ਹਾਂ ਮੈਂ ਇਸਨੂੰ ਸਿੱਖ ਕੇ ਦੋ ਤੋਂ ਸਾਲ ਸ ਗਾਇਆ ਹੈ ਅਤੇ ਹਲੇ ਵੀ ਮੈਂ ਇਸ ਗੀਤ ਨੂੰ ਗਾਉਂਦਾ ਰਹਿੰਦਾ ਹਾਂ ਅਤੇ ਇਸ ਵਿੱਚ ਕਈ ਤਰ੍ਹਾਂ ਦੇ ਰਾਗ ਬੰਦਿਸ਼ਾਂ ਜੋ ਕਿ ਕਈ ਤਰ੍ਹਾਂ ਦੇ ਘਰਾਣਿਆਂ ਦੀਆਂ ਖਾਸ ਤੌਰ 'ਤੇ ਪਟਿਆਲਾ ਘਰਾਣੇ ਦੀ ਬੰਦਿਸ਼ਾਵਾਂ ਆਮ ਤੌਰ 'ਤੇ ਘਰ ਰਿਆਜ਼ ਦੌਰਾਨ ਗਾਉਂਦਾ ਰਹਿੰਦਾ ਹਾਂ ਅਤੇ ਮੇਰੇ ਦੋਸਤ ਮਿੱਤਰ ਵੀ ਮੇਰੇ ਕੋਲੋਂ ਇਸ ਸੰਗੀਤ ਨੂੰ ਸੁਣਨਾ ਬਹੁਤ ਪਸੰਦ ਕਰਦੇ ਹਨ